ਪੰਜਾਬੀ ਭਾਸ਼ਾ ਇੱਕ ਬਹੁਤ ਹੀ ਜਗਤ ਪ੍ਰਸਿੱਧ ਭਾਸ਼ਾ ਹੈ ਇਹ ਭਾਸ਼ਾ ਪੰਜਾਬ ਦੇ ਹਰ ਇੱਕ ਜਿਲ੍ਹੇ ਵਿੱਚ ਬੋਲੀ ਜਾਂਦੀ ਹੈ ਇਤਿਹਾਸ ਵਿੱਚ ਜਦੋਂ ਅਸੀਂ ਪਿੱਛੇ ਵੱਲ ਨੂੰ ਨਜ਼ਰ ਮਾਰਦੇ ਹਾਂ ਪੰਜਾਬ ਵਿੱਚ ਬਹੁਤ ਸਾਰੇ ਮੁਗਲ ਸਮਰਾਟਾਂ ਨੇ ਅਬਦਾਲੀ ਮੀਰ ਮਨੂ ਵਰਗਿਆਂ ਨੇ ਹਮਲੇ ਕੀਤੇ ਹਨ ਅਤੇ ਇੱਥੋਂ ਹਮੇਸ਼ਾ ਹੀ ਸੱਭਿਆਚਾਰ ਦਾ ਫੇਰ ਬਦਲ ਹੁੰਦਾ ਆਇਆ ਹੈ ਕਦੇ ਇੱਥੇ ਫ਼ਾਰਸੀ ਕਦੇ ਉਰਦੂ ਦਾ ਬੋਲਬਾਲਾ ਰਿਹਾ ਹੈ ਕਦੇ ਹਿੰਦੀ ਦਾ ਬੋਲਬਾਲਾ ਰਿਹਾ ਹੈ ਪਰ ਫਿਰ ਵੀ ਢਹਿੰਦੀ ਉੱਠਦੀ ਪੰਜਾਬੀ ਹੋਂਦ ਵਿੱਚ ਆਉਂਦੀ ਰਹੀ ਹੈ ਅਤੇ ਇੱਥੇ ਗੁਰੂ ਮਹਾਰਾਜਿਆਂ ਨੇ ਬਹੁਤ ਸਾਰੀ ਕੁਰਬਾਨੀਆਂ ਦੇ ਕੇ ਪੰਜਾਬੀ ਭਾਸ਼ਾ ਨੂੰ ਆਬਾਦ ਰੱਖਿਆ ਹੈ ਅਤੇ ਅੱਜ ਫਿਰ ਵੀ ਪੰਜਾਬ ਦੇ ਲੋਕ ਅੰਗਰੇਜ਼ੀ ਸਿੱਖ ਸਿੱਖ ਕੇ ਬਾਹਰਲੇ ਮੁਲਖਾਂ ਨੂੰ ਜਾ ਰਹੇ ਹਨ ਅਤੇ ਬਿਹਾਰ ਯੂਪੀ ਮਹਾਰਾਸ਼ਟਰ ਦੇ ਲੋਕ ਪੰਜਾਬ ਵਿੱਚ ਆ ਕੇ ਵੱਸ ਰਹੇ ਹਨ ਫਿਰ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸਿਰ ਮੱਥੇ ਪ੍ਰਵਾਨ ਕਰਦੀ ਹੋਈ ਪੰਜਾਬੀ ਇੱਕ ਬੜੀ ਹੀ ਜਿਗਰੇ ਵਾਲੀ ਭਾਸ਼ਾ ਅੱਜ ਵੀ ਆਬਾਦ ਹੈ ਅਤੇ ਸਦਾ ਹੀ ਆਬਾਦ ਰਹੇਗੀ